ਪੰਜਾਬ ਵਿੱਚ ਕਈ ਥਾਵਾਂ ਹਨ ਜਿੱਥੇ ਲੋਕ ਦੂਰੋਂ ਦੂਰੋਂ ਆਉਂਦੇ ਹਨ ਘੁੰਮਣ ਫਿਰਨ ਵਾਸਤੇ ਕਈ ਥਾਵਾਂ ਇਹੋ ਜਿਹੀਆਂ ਨੇ ਜਿੱਥੇ ਲੋਕ ਦੂਰੋਂ ਦੂਰੋਂ ਮੱਥਾ ਟੇਕਣ ਆਉਂਦੇ ਹਨ ਪੰਜਾਬ ਵਿੱਚ ਕੁਛ ਗੱਲਾਂ ਕੁਛ ਹੈ ਐਸੇ ਸਥਾਨ ਜਿਨ੍ਹਾਂ ਬਾਰੇ ਮੈਂ ਤੁਹਾਨੂੰ ਅੱਜ ਸਾਂਝਾ ਕਰਾਂਗਾ ਕੁਝ ਨੇ ਦਰਬਾਰ ਸਾਹਿਬ ਕਾਠਗੜ ਮੁਕਤੇਸ਼ਵਰ ਧਾਮ ਸ਼੍ਰੀ ਮਾਤਾ ਵੈਸ਼ਨੋ ਦੇਵੀ ਅਨੰਦਪੁਰ ਸਾਹਿਬ ਅੱਜ ਤੁਹਾਡੇ ਨਾਲ ਮੈਂ ਸ਼੍ਰੀ ਕਾਠਗੜ ਬਾਰੇ ਤਾਂ ਮੈਂ ਸਾਂਝਾ ਕਰਨ ਜਾ ਰਿਹਾ ਹਾਂ ਜਿਵੇਂ ਕਾਠਗੜ ਦੇ ਇਤਿਹਾਸ ਬਹੁਤ ਹੀ ਵਧੀਆ ਹੈ ਕਾਠਗੜ ਹਿਮਾਚਲ ਪ੍ਰਦੇਸ਼ ਦੇ ਵਿੱਚ ਸਥਿਤ ਹੈ ਇਹ ਸ਼ਿਵ ਮਹਾਰਾਜ ਜੀ ਦਾ ਮੰਦਰ ਹੈ ਕਾਠਗੜ ਬਹੁਤ ਹੀ ਵਧੀਆ ਮੰਦਰ ਬਣਿਆ ਹੋਇਆ ਇੱਥੇ ਸ਼ਰਧਾਲੂ ਦੁਰੋਂ ਦੁਰੋਂ ਮੱਥਾ ਟੇਕਣ ਆਉਂਦੇ ਹਨ ਕਈ ਲੋਕ ਪੰਜਾਬ ਤੋਂ ਵੀ ਜਾਂਦੇ ਹਨ ਕਈ ਲੋਕ ਮਹਾਰਾਸ਼ਟਰ ਤੋਂ ਵੀ ਆਉਂਦੇ ਹਨ ਕਈ ਲੋਕ ਜੰਮੂ ਤੋਂ ਵੀ ਆਉਂਦੇ ਹਨ ਇੱਥੇ ਲੋਕ ਰਾਤ ਨੂੰ ਵੀ ਸਟੇਅ ਕਰਦੇ ਹਨ ਜਿਵੇ ਕਿ ਗੱਲ ਕੀਤੀ ਜਾਵੇ ਕਾਠਗੜ ਦੇ ਕਾਠਗੜ 'ਚ ਜਿਸ ਦਿਨ ਸ਼ਿਵਰਾਤਰੀ ਹੁੰਦੀ ਆ ਉਸ ਦਿਨ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਉੱਥੇ ਚੌਵੀ ਘੰਟੇ ਅਟੁੱਟ ਲੰਗਰ ਵਰਤਦਾ ਹੈ ਇੱਥੇ ਲੋਕ ਰਾਤ ਨੂੰ ਸਟੇਅ ਵੀ ਕਰਦੇ ਹਨ ਜੇਕਰ ਅਸੀਂ ਗੱਲ ਕਰੀਏ ਜਗਰਾਤੇ ਦਾ ਕੀ ਮੁੱਲ ਹੈ ਇੱਥੇ ਜਗਰਾਤੇ ਵਾਲੇ ਦਿਨ ਸੁਣਿਆ ਗਿਆ ਹੈ ਕਿ ਜਗਰਾਤੇ ਵਾਲੇ ਦਿਨ ਰਾਤ ਨੂੰ ਸ਼ਿਵ ਮਹਾਰਾਜ ਜੀ ਅਤੇ ਪਾਰਵਤੀ ਮਾਤਾ ਜੀ ਦੀ ਮੂਰਤੀ ਇਕੱਠੀ ਹੁੰਦੀ ਹੈ ਜੋ ਜੋ ਉਸਨੂੰ ਦੇਖਦਾ ਹੈ ਜੋ ਆਪਣੀ ਮੰਨਤ ਮੰਗਦਾ ਉਸ ਦੀ ਮੰਨਤ ਪੂਰੀ ਹੁੰਦੀ ਹੈ ਇਹ ਸਭ ਨੂੰ ਦੇਖ ਕੇ ਲੋਕ ਬੜੇ ਬੜੇ ਆਪਣੀ ਮੰਨਤਾਂ ਮੰਗਦੇ ਹਨ ਜੋ ਕਿ ਪੂਰੀਆਂ ਵੀ ਹੁੰਦੀਆਂ ਹਨ ਇਸ ਕਾਠਗੜ ਕਾਠਗੜ ਇੱਕ ਬਹੁਤ ਹੀ ਵਧੀਆ ਡੈਸਟੀਨੇਸ਼ਨ ਹੈ ਜਿੱਥੇ ਲੋਕ ਫੋਟੋਆਂ ਖਿੱਚਦੇ ਹਨ ਇੱਥੇ ਵਧੀਆ ਇੱਕ ਸਰੋਵਰ ਬਣਿਆ ਹੋਇਆ ਹੈ ਵਧੀਆ ਵਧੀਆ ਪਿਕਚਰਸ ਬਣੀਆਂ ਹੋਈਆਂ ਹਨ ਵਧੀਆ ਵਧੀਆ ਸਿਨਮੈਟੋਗ੍ਰਾਫੀ ਕੀਤੀ ਗਈ ਹੈ ਜਿੱਥੇ ਵਧੀਆ ਲੋਕ ਆਪਣਾ ਅਨੰਦ ਲੁੱਟਦੇ ਹਨ ਨਾਲੇ ਫੋਟੋਆਂ ਖਿੱਚਦੇ ਹਨ ਨਾਲੇ ਬਹੁਤ ਹੀ ਅਨੰਦ ਮਾਣਦੇ ਹਨ